ਇਸ ਸੁਨੇਹੇ ਰਾਹੀਂ ਅਸੀਂ ਸੈਮਸੰਗ ਦੇ ਫਰਿੱਜ ਰਿਪੋਰਟ ਸਾਂਝੀ ਕਰ ਰਹੇ ਹਾਂ ਇਹ ਜੋ ਪ੍ਰੋਡਕਟ ਹੈ ਸੈਮਸੰਗ ਦਾ ਫਰਿੱਜ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਇਹਦੇ ਵਿੱਚ ਵੱਖ ਵੱਖ ਸੁਵਿਧਾਵਾਂ ਦਿੱਤੀਆਂ ਗਈਆਂ ਨੇ ਗ੍ਰਾਹਕ ਨੂੰ ਇਸ ਵਿੱਚ ਜੋ ਪਾਣੀ ਨੂੰ ਠੰਡਾ ਕਰਕੇ ਬਰਫ 'ਚ ਬਰਫ ਵਿੱਚ ਢਾਲਣ ਦੀ ਜੋ ਪ੍ਰਕਿਰਿਆ ਹੈ ਬਹੁਤ ਹੀ ਸਹਿਜ ਹੈ ਅਤੇ ਨਾਲ ਹੀ ਜੋ ਖਾਦ ਪਦਾਰਥ ਨੇ ਇਹਦੇ ਵਿੱਚ ਸੁਰੱਖਿਅਤ ਰਹਿੰਦੇ ਨੇ ਅਤੇ ਦੋ ਦਿਨ ਬਾਅਦ ਤਿੰਨ ਦਿਨ ਬਾਅਦ ਵੀ ਖਾਣਯੋਗ ਹੁੰਦੇ ਨੇ ਸੋ ਜੋ ਠੰਡਕ ਇਸ ਫਰਿੱਜ ਦੁਆਰਾ ਵੱਖ ਵੱਖ ਖਾਦ ਪਦਾਰਥਾਂ ਨੂੰ ਮੁਹੱਈਆ ਕਰਵਾਈ ਜਾਂਦੀ ਹੈ ਉਹ ਬਹੁਤ ਹੀ ਸ਼ਾਨਦਾਰ ਹੈ ਸੋ ਅਸੀਂ ਹੋਰ ਵੀ ਗਾਹਕਾਂ ਨੂੰ ਇਹ ਸੁਨੇਹਾ ਦਿੰਦੇ ਹਾਂ ਕਿ ਇਹ ਜੋ ਪ੍ਰੋਡਕਟ ਹੈ ਬਹੁਤ ਵਧੀਆ ਹੈ ਅਤੇ ਇਹ ਵਰਤਣਯੋਗ ਹੈ